ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਸਾਫ਼ ਰੱਖਣ ਲਈ ਬਹੁਤ ਕੋਸ਼ਿਸ਼ਾਂ ਕਰਦੇ ਹਾਂ ਜਿਵੇਂ ਜਗ੍ਹਾ ਜਗ੍ਹਾ 'ਤੇ ਡਸਟਬਿਨ ਰੱਖੇ ਹੋਏ ਹਨ ਜਿਸ ਨੂੰ ਕੁਝ ਵੀ ਫਾਲਤੂ ਸਮਾਨ ਖਾ ਕੇ ਸੁੱਟਣਾ ਹੋਵੇ ਉਹ ਇੱਧਰ ਉੱਧਰ ਨਾ ਸੁੱਟੇ ਡਸਟਬਿਨ ਵਿੱਚ ਹੀ ਪਾਏ ਜਿਸ ਕਰਕੇ ਸਾਡਾ ਆਸਾ ਪਾਸਾ ਸਾਫ਼ ਰਹਿੰਦਾ ਹੈ ਰੋਜ਼ ਜਮਾਂਦਾਰ ਸਫਾਈ ਕਰਦਾ ਹੈ ਅਸੀਂ ਪਾਰਕ ਵੀ ਬਣਾਇਆ ਹੋਇਆ ਹੈ ਉਸ ਵਿੱਚ ਸੋਹਣੇ ਫੁੱਲ ਬੂਟੇ ਲਗਾਏ ਹੋਏ ਹਨ ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਜਿੰਮ ਦਾ ਸਮਾਨ ਵੀ ਲਗਾਇਆ ਹੋਇਆ ਹੈ ਅਸੀਂ ਸਾਰੇ ਉੱਥੇ ਰੋਜ਼ ਸੈਰ ਕਰਦੇ ਹਾਂ ਬੱਚੇ ਖੇਡਦੇ ਹਨ ਅਸੀਂ ਪੌਦਿਆਂ ਨੂੰ ਪਾਣੀ ਪਾਉਂਦੇ ਹਾਂ ਕਬੂਤਰਾਂ ਨੂੰ ਦਾਣਾ ਪਾਣੀ ਪਾਉਣ ਲਈ ਵੱਖਰਾ ਬਰਤਨ ਰੱਖਿਆ ਹੋਇਆ ਹੈ ਅਤੇ ਕਬ ਕੁੱਤਿਆਂ ਲਈ ਅਲੱਗ ਬਰਤਨ ਰੱਖੇ ਹੋਏ ਹਨ ਉਸ ਵਿੱਚ ਦੁੱਧ ਬਿਸਕਿਟ ਪਾ ਕੇ ਰੱਖਦੇ ਹਾਂ